ਸਤਿ ਸ਼੍ਰੀ ਅਕਾਲ ਸਰ ਸਨੀ ਟੂਰ ਐਂਡ ਟਰੈਵਲ ਤੋਂ ਬੋਲਦੇ ਐ ਜੀ ਸਰ ਮੈਂ ਨਾ ਇੱਕ ਰੇਲਵੇ ਟਿਕਟ ਬੁੱਕ ਕਰਾਉਣੀ ਸੀ ਬੰਬੇ ਤੋਂ ਹੈਗਾ ਇੱਥੇ ਜਲੰਧਰ ਤੱਕ ਦੀ ਬੰਬੇ ਤੋਂ ਆਉਣਾ ਅਤੇ ਜਲੰਧਰ ਤੱਕ ਆਉਣਾ ਅਤੇ ਮੈਂ ਲਗਭਗ ਇਸ ਮਹੀਨੇ ਦੀ ਪੱਚੀ ਤਰੀਕ ਦੀ ਟਿਕਟ ਬੁੱਕ ਕਰਾਉਣੀ ਸੀ ਅਤੇ ਮੇਰੀ ਜੋ ਆਈ ਡੀ ਹੈ ਉਹ ਹੈ ਇੱਕ ਇੱਕ ਚਾਰ ਪੰਜ ਦੋ ਇੱਕ ਅਤੇ ਮੇਰਾ ਜੋ ਪਾਸਵਰਡ ਹੈ ਉਹ ਹੈ ਇੱਕ ਇੱਕ ਦੋ ਇੱਕ ਅਤੇ ਮੈਨੂੰ ਇੱਕ ਤੁਹਾਡੇ ਮਦਦ ਦੀ ਲੋੜ ਹੈ ਤੁਸੀਂ ਜਲਦ ਤੋਂ ਜਲਦ ਟਿਕਟ ਬੁੱਕ ਕਰ ਦਿਓ ਕਿਉਂਕਿ ਇੱਥੋਂ ਟਿਕਟ ਬੁੱਕ ਨਹੀਂ ਹੋ ਰਹੀ ਅਤੇ ਮੈਂ ਆਸ ਕਰਦਾ ਤੁਸੀਂ ਜਲਦੀ ਤੋਂ ਜਲਦੀ ਮੇਰੀ ਟਿਕਟ ਬੁੱਕ ਕਰਕੇ ਮੈਨੂੰ ਕੋਲ ਜਾਂ ਮੈਸਿਜ ਰਾਹੀਂ ਉਸ ਟਿਕਟ ਦੀ ਫੋਟੋ ਜਾਂ ਮੇਰੀ ਮੇਲ ਆਈ ਡੀ ਰਾਹੀਂ ਮੈਨੂੰ ਭੇਜ ਦਿਓ ਅਤੇ ਮੇਰੀ ਮੇਲ ਆਈ ਡੀ ਹੈਗੀ ਆ ਟਰਿਪਲ ਵਨ ਐਟ ਦੀ ਰੇਟ ਜੀਮੇਲ ਡੋਟ ਕੋਮ ਅਤੇ ਮੈਂ ਚਾਹੁੰਦਾ ਹਾਂ ਤੁਸੀਂ ਜਲਦੀ ਤੋਂ ਜਲਦੀ ਟਿਕਟ ਭਰੋ ਅਤੇ ਮੈਂ ਤੁਹਾਨੂੰ ਜੋ ਪੇਮੈਂਟ ਹੈ ਉਹ ਉਸਦੀ ਵੀ ਤੁਸੀਂ ਉਸ ਬਾਰੇ ਮੈਨੂੰ ਦੱਸ ਦਿਓ ਅਤੇ ਮੈਂ ਗੁਗਲ ਪੇਮੈਂਟ ਜਾਂ ਬੈਂਕ ਰਾਹੀਂ ਤੁਹਾਡੇ ਅਕਾਊਟ ਵਿੱਚ ਪੈਸੇ ਟ੍ਰਾਂਸਫਰ ਕਰ ਦਿਆਂਗਾ